ਖੁੱਲੇ ਪਾਣੀ ਵਿੱਚ ਤੈਰਾਕੀ ਕਰਦੇ ਸਮੇਂ ਸੁਰੱਖਿਅਤ ਰਹਿਣ ਲਈ ਕਈ ਤਰੀਕੇ ਹਨ ਜਿਵੇਂ ਕਿ ਉਹ ਆਪਾਂ ਨੂੰ ਟਿਊਬ ਪ੍ਰੋਵਾਈਡ ਕਰਵਾ ਦਿੰਦੇ ਨੇ ਟਿਊਬ ਦਿੰਦੇ ਨੇ ਪਾਉਣ ਵਾਸਤੇ ਉਹਦੇ ਨਾਲ ਬੰਦਾ ਡੁੱਬਦਾ ਨਹੀਂ ਹੈ ਇੱਕ ਜੈਕਟਾਂ ਆਉਂਦੀਆ ਉਹ ਪਾਣੀ ਵਿੱਚ ਫੁੱਲ ਜਾਂਦੀਆਂ ਨੇ ਉਸ ਦੇ ਨਾਲ ਆਪਾਂ ਤੈਰਨਾ ਵੀ ਸੌਖੇ ਤਰੀਕੇ ਨਾਲ ਸਿੱਖ ਸਕਦੇ ਹਾਂ ਅਤੇ ਆਪਾਂ ਨੂੰ ਡੁੱਬਣ ਦਾ ਵੀ ਕੋਈ ਖ਼ਤਰਾ ਨਹੀਂ ਜਿਹੜੇ ਨਵੇਂ ਸਿੱਖਣ ਵਾਲੇ ਨੇ ਅਤੇ ਇਹ ਜਿਵੇਂ ਬਾਹਰਲੀਆਂ ਖੁੱਲ੍ਹੀਆਂ ਥਾਵਾਂ ਹੁੰਦੀਆਂ ਜਿੱਥੇ ਐਲਗੀ ਹੁੰਦੀ ਆ ਜਾਂ ਕਿ ਤਿਲਕਣ ਵਾਲੀਆਂ ਥਾਵਾਂ ਹੁੰਦੀਆਂ ਚੱਟਾਨਾਂ ਹੁੰਦੀਆਂ ਉੱਥੇ ਕਈ ਵਾਰੀ ਉਹਨਾਂ ਨੇ ਮੋਟੇ ਸੰਗਲ ਲਾਏ ਹੁੰਦੇ ਹਨ ਪੰਜਾਬ ਦੇ ਵਿੱਚ ਜ਼ਿਆਦਾਤਰ ਸੰਗਲ ਹੀ ਲੱਗੇ ਹੁੰਦੇ ਹਨ ਤਾਂ ਜੋ ਕਿ ਉਹਨੂੰ ਫੜ ਕੇ ਬੰਦਾ ਵਿੱਚ ਜਾ ਸਕੇ ਜਾਂ ਕੋਈ ਜਿਸ ਨੇ ਤੈਰਾਕੀ ਸਿੱਖਣੀ ਉਹ ਸੰਗਲ ਦੇ ਰਾਹੀਂ ਵੀ ਤੈਰਾਕੀ ਸਿੱਖਦਾ ਹੈ ਜ਼ਿਆਦਾ ਅੱਗੇ ਨਹੀਂ ਜਾਣਾ ਅਤੇ ਪਿੱਛੇ ਪਿੱਛੇ ਰਹਿ ਕੇ ਉਹ ਤੈਰਨਾ ਹਲਕਾ ਸਿੱਖ ਸਕਦਾ ਹੈ ਜਿਵੇਂ ਆਪਾਂ ਕਹਿ ਦਿੰਦੇ ਹਾਂ ਕਿ ਸ਼ੁਰੂਆਤੀ ਤੌਰ ਦੇ ਦਿਨਾਂ ਵਿੱਚ ਉਹ ਚੀਜ਼ਾਂ ਦਾ ਵਰਤੋਂ ਕਰਨੀ ਜ਼ਰੂਰੀ ਹੁੰਦੀ ਆ